ਟੈਕਨੋਲਜੀ ਨੇ ਬੈਂਕਿੰਗ ਨੂੰ ਕਾਫੀ ਆਸਾਨ ਅਤੇ ਸੌਖਾ ਬਣਾ ਦਿੱਤਾ ਹੈ ਜਿਸ ਨਾਲ ਲਗਭਗ ਹਰ ਕੋਈ ਵਿਅਕਤੀ ਆਪਣੀ ਬੈਂਕਿੰਗ ਜ਼ਰੂਰਤਾਂ ਨੂੰ ਘਰ ਬੈਠੇ ਹੀ ਪੂਰਾ ਕਰ ਸਕਦਾ ਹੈ ਆਨਲਾਈਨ ਬੈਂਕਿੰਗ ਮੋਬਾਈਲ ਐਪਸ ਅਤੇ ਡਿਜੀਟਲ ਵਾਲਟਾਂ ਨੇ ਬੈਕਿੰਗ ਦੀ ਪ੍ਰਕਿਰਿਆ ਨੂੰ ਸਧਾਰਨ ਕੀਤਾ ਹੈ ਜਿਸ ਨਾਲ ਪੈਸੇ ਦਾ ਭੁਗਤਾਨ ਲੈਣ ਦੇਣ ਖਾਤਾ ਪ੍ਰਬੰਧਨ ਆਨਲਾਈਨ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਨਵੀਂ ਤਕਨਾਲੋਜੀ ਨਾਲ ਕਈ ਵਾਰ ਮੈਂ ਮਨੁੱਖੀ ਦਖਲਅੰਦਾਜ਼ੀ ਦੀ ਘਾਟ ਨੂੰ ਮਹਿਸੂਸ ਕਰਦਾ ਹਾਂ ਜਿਸ ਨਾਲ ਜ਼ਰੂਰੀ ਸੁਝਾਅ ਜਾਂ ਸਹਾਇਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਤਕਨੀਕੀ ਗੜਬੜਾਂ ਜਾਂ ਸੁਰੱਖਿਆ ਦੇ ਮੱਦੇਨਜ਼ਰ ਹੋਰ ਵੀ ਕਈ ਪ੍ਰੋਬਲਮਾਂ ਉਤਪੰਨ ਹੋ ਜਾਂਦੀਆਂ ਜਿਸ ਨਾਲ ਸੰਚਾਰ ਅਤੇ ਲੈਣ ਦੇਣ ਦੀ ਜ਼ਰੂਰਤ ਜਾਣਕਾਰੀ ਦਾ ਅਭਾਵ ਹੋ ਸਕਦਾ ਹੈ ਇਸ ਤਰ੍ਹਾਂ ਤਕਨਾਲੋਜੀ ਨੇ ਬੈਂਕਿੰਗ ਨੂੰ ਆਸਾਨ ਬਣਾਉਣ ਦੇ ਨਾਲ ਨਾਲ ਕੁਝ ਨਵੀਆਂ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ ਜਿਵੇਂ ਕਹਿੰਦੇ ਆ ਵੀ ਜੇਕਰ ਕਿਸੇ ਚੀਜ਼ ਦਾ ਕੋਈ ਲਾਭ ਹੈ ਤਾਂ ਉਸ ਦੀਆਂ ਹਾਨੀਆਂ ਵੀ ਹੁੰਦੀਆਂ ਹਨ